ਬਦਲਦੇ ਮੌਸਮ ਨੇ ਸਾਡੀ ਖੇਤੀ 'ਤੇ ਬਹੁਤ ਅਸਰ ਅਸਰ ਪਾਇਆ ਹੈ ਹੜ੍ਹਾਂ ਵਿੱਚ ਫ਼ਸਲ ਤਬਾਹ ਹੋ ਜਾਂਦੀ ਹੈ ਸੋਕੇ ਵਿੱਚ ਫ਼ਸਲ ਸੁੱਕ ਜਾਂਦੀ ਹੈ ਗੜ੍ਹੇ ਨਾਲ਼ ਫ਼ਸਲ ਖ਼ਰਾਬ ਹੋ ਜਾਂਦੀ ਹੈ ਇਹ ਕੁਦਰਤੀ ਆਫ਼ਤਾਂ ਨੂੰ ਨਹੀਂ ਕੋਈ ਨਹੀਂ ਰੋਕ ਸਕਦਾ ਇਹਨਾਂ ਨਾਲ਼ ਨਜਿੱਠਣਾ ਰੱਬ ਨਾਲ਼ ਨਜਿੱਠਣ ਦੇ ਬਰਾਬਰ ਹੈ ਹੜ੍ਹਾਂ ਨੂੰ ਰੋਕਣ ਲਈ ਸਾਨੂੰ ਨਦੀਆਂ ਨਦੀਆਂ ਨਾਲ਼ੇ ਸਾਫ ਰੱਖਣੇ ਚਾਹੀਦੇ ਹਨ ਨਦੀਆਂ ਦੇ ਆਲੇ ਦੁਆਲੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂਕਿ ਪਾਣੀ ਪਾਣੀ ਨੂੰ ਰੋਕ ਪਾਣੀ ਨੂੰ ਰੋਕ ਸਕਣ ਹੜ੍ਹਾਂ ਨੂੰ ਸੋਕੇ ਟਾਈਮ ਨਦੀਆਂ ਦਾ ਪਾਣੀ ਵਰਤਣਾ ਚਾਹੀਦਾ ਹੈ